ਹਾਂਜੀ ਸੀਵੀਆਂ ਸਾਈਕਲ ਰਹੇ ਜੀ ਅਸੀਂ ਨਾ ਸਰ ਇੱਕ ਸਾਈਕਲ ਲੈਣਾ ਜੀ ਤ ਤੁਹਾਡੇ ਕੋਲ ਸਰ ਕਿਹੜੇ ਕਿਹੜੇ ਸਾਈਕਲ ਆ ਜੀ

ਅਸੀਂ ਨਾ ਜੀ ਰੇਂਜਰ ਸਾਈਕਲ ਲੈਣਾ ਔਰ ਲੈਣਾ ਮੈਂ ਆਪਣੇ ਲਈ ਆ ਵੱਡਾ ਸਾਈਕਲ ਹੀ ਚਾਹੀਦਾ ਜੀ ਰੇਂਜਰ 'ਚ ਹਾਂਜੀ ਇਹਦੇ ਲਈ ਸਾਨੂੰ ਦੱਸੋਗੇ ਜੀ ਉਹਦੇ 'ਚ ਬਜਟ ਕਿਹੜੇ ਕਿਹੜੇ ਬਜਟ ਦੇ ਸਾਈਕਲ ਆ ਰੇਂਜਰ 'ਚ ਹਾਂਜੀ ਹਾਂਜੀ ਅਸੀਂ ਵੈਸੇ ਇੱਕ ਤਾਂ ਸਾਈਕਲਿੰਗ ਲਈ ਹੋ ਜਾਵੇ ਜਿਹੜਾ ਅਤੇ ਬਸ ਦਸ ਕੁ ਕਿਲੋਮੀਟਰ ਜਿਹੜਾ ਅਸੀਂ ਰੋਜ਼ਾਨਾ ਦਾ ਚਲਾ ਸਕੀਏ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਉਹ ਕਿੰਨੀ ਕੁ ਰੇਂਜ ਤੱਕ ਦੇ ਤੁਹਾਡੇ ਕੋਲ

ਠੀਕ ਹੈ ਜੀ ਅਸੀਂ ਤਾਂ ਦਸ ਕੁ ਤੱਕ ਸੋਚ ਰਹੇ ਜੀ ਦਸ ਬਾਰਾਂ ਦੇ ਵਿੱਚ ਵਿੱਚ ਠੀਕ ਹੈ ਜੀ

ਹਾਂਜੀ ਹਾਂਜੀ ਇੱਕ ਨਾ ਸਾਡੇ ਕੋਲ ਪੁਰਾਣਾ ਸਾਈਕਲ ਖੜਾ ਜੀ ਰੇਂਜਰ ਬਾਹਲੀ ਚੰਗੀ ਹਾਲਤ ਨਹੀਂ ਆ ਉਹਦੀ ਉਹ ਤੁਸੀਂ ਕੱਟ ਸਕਦੇ ਹੋ ਵਿੱਚ ਜੇ ਹੈ ਸਕੀਮ ਇੱਦਾਂ ਦੀ ਕਿ ਨਹੀਂ ਚਲੋ ਠੀਕ ਆ ਸਰ ਫਿਰ ਅਸੀਂ ਨਾ ਵਿਜ਼ਿਟ ਕਰਦੇ ਹਾਂ ਤੁਹਾਡੇ ਸਟੋਰ 'ਤੇ ਫਿਰ ਉਸ ਦਿਨ ਦੇਖ ਕੇ ਫਿਰ ਸਾਇਕਲ ਲੈ ਕੇ ਜਾਵਾਂਗੇ ਠੀਕ ਹੈ ਓਕੇ